ਮੈਂ ਆਪਣੇ ਜੀਵਨ ਵਿੱਚ ਹਰ ਰੋਜ਼ ਟੈਕਨੋਲੋਜੀ ਦੀ ਵਰਤੋਂ ਮੋਬਾਈਲ ਮੋਬਾਈਲ ਯੂਸ ਕਰਦੇ ਹੋਏ ਕਰਦਾ ਹਾਂ ਇੰਟਰਨੈਟ ਦੀ ਸਰਵਿਸ ਯੂਸ ਕਰਦਾ ਹਾਂ ਅਤੇ ਕਾਰ ਡਰਾਈਵ ਕਰਦੇ ਟਾਈਮ ਮੈਨੂੰ ਸਾਰੇ ਕਾਰ ਦੇ ਫੰਕਸ਼ਨ ਪਤਾ ਹੋਣ ਇਸ ਲਈ ਮੈਂ ਕਾਰ ਵੀ ਡਰਾਈਵ ਕਰਦਾ ਉਸ ਤੋਂ ਬਾਅਦ ਘਰ ਕੁਕਿੰਗ ਦੇ ਵਿੱਚ ਸਾਡੇ ਮਾਈਕਰੋ ਓਵਨ ਜੋ ਹੈ ਉਸਦੇ ਵਿੱਚ ਕਿਸ ਤਰ੍ਹਾਂ ਇਲੈਕਟਰੀਕਲ ਕਰੰਟ ਮੂਵ ਕਰਦਾ ਹੈ ਕਿਸ ਤਰ੍ਹਾਂ ਹੀਟ ਅਪ ਹੁੰਦਾ ਹੈ ਉਹ ਸਮਝਿਆ ਇਸ ਤੋਂ ਇਲਾਵਾ ਟੈਕਨੋਲੋਜੀ ਵੀ ਜੋ ਵੀ ਕੰਸਟਰਕਸ਼ਨ ਦੇ ਜੋਬ ਵਿੱਚ ਮਟੀਰੀਅਲ ਯੂਸ ਹੁੰਦਾ ਹੈ ਉਹਦੀ ਵਰਤੋਂ ਕਿਵੇਂ ਕਰਨੀ ਹੈ ਉਹ ਮੈਂ ਦੇਖਦਾ ਹਾਂ ਔਰ ਇਸ ਤੋਂ ਇਲਾਵਾ ਵੀ ਸੇਫਟੀ ਦੇ ਰੂਲ ਰੋਡਸ ਦੇ ਉੱਤੇ ਕਿਹੜੇ ਕਿਹੜੇ ਰੂਲ ਹੋਣੇ ਚਾਹੀਦੇ ਸੇਫਟੀ ਰੂਲ ਐਟ ਦਾ ਰੋਡ ਇਹ ਜਾਣ ਦੀ ਕੋਸ਼ਿਸ਼ ਕਰਦਾ ਹਾਂ ਅਤੇ ਔਰ ਨਵੀਆ ਨਵੀਆਂ ਬੁੱਕਸ ਪੜ੍ਹਦਾ ਹਾਂ ਔਰ ਨਵੇਂ ਨਵੇਂ ਟੈਕਨੋਲੋਜੀ ਦੇ ਨਵੇਂ ਨਵੇਂ ਸਬਜੈਕਟ ਦੀ ਧਿਆਨ ਦਿੰਦਾ